ਹੈਲੋ ਹਾਂਜੀ ਹਾਂਜੀ ਅੱਛਾ ਅੱਛਾ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਅੱਛਾ ਹਾਂਜੀ ਅੱਛਾ ਬਿਲਕੁਲ ਜੀ ਅਹਾ ਹਾਂਜੀ ਉਹਨਾਂ ਦਾ ਤਾਂ ਬਿਲਕੁਲ ਹੀ ਜਿਵੇਂ ਉਹ ਜਿਵੇਂ ਹੁਣ ਮਾਨਸਾ ਏਰੀਆ ਸਾਡਾ ਹੀ ਸਿੱਧੂ ਮੂਸੇ ਵਾਲਾ ਪਿੰਡ ਹੈ ਮਾਨਸਾ ਦੇ ਬਿਲਕੁਲ ਲਾਗੇ ਹੈ ਅਤੇ ਉਹਨੂੰ ਵੈ ਉਹਨਾਂ ਨੂੰ ਵੈਸੇ ਵੀ ਜਿਵੇਂ ਕਹਿ ਲਓ ਤੁਸੀਂ ਟਿੱਬਿਆਂ ਦਾ ਪੁੱਤ ਹੀ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਬਾਕੀ ਜੋ ਵੀ ਦੁਨੀਆ ਐਂਗੀ ਜਾਂ ਜੋ ਵੀ ਸਿੰਗਰ ਆ ਜਾਂ ਜੋ ਵੀ ਵੱਡੇ ਲੋਕ ਹੁੰਦੇ ਆ ਹਮੇਸ਼ਾ ਹੀ ਫੇਮਸ ਹੋ ਕੇ ਆਪਣਾ ਪਿੰਡ ਛੱਡ ਕੇ ਸ਼ਹਿਰ ਛੱਡ ਕੇ ਵਿਦੇਸ਼ ਨੂੰ ਜਾਂ ਵੱਡੇ ਸ਼ਹਿਰਾਂ 'ਚ ਸੈਟਲ ਹੁੰਦੇ ਆ ਲੇਕਿਨ ਹਾਂ ਉਹਨਾਂ ਦੀ ਸਪੈਸ਼ਲ ਇਹ ਹੀ ਹੈ ਵੀ ਉਹ ਸਿਰਫ਼ ਆਪਣੇ ਪਿੰਡ ਨੂੰ ਹੀ ਉੱਥੇ ਹੀ ਉਹਨਾਂ ਨੇ ਬਹੁਤ ਅੱਛੀ ਇੱਕ ਹਵੇਲੀ ਬਣਾਈ ਹੈ ਅਤੇ ਉਹਨੂੰ ਹੀ ਉੱਥੇ ਹੀ ਆਪਣੇ ਪਿੰਡ 'ਚ ਰਹਿ ਕੇ ਹੀ ਪੰਜਾਬੀ ਕਲਚਰ ਨੂੰ ਆ ਜਿਹੜਾ ਉਹ ਅੱਗੇ ਪ੍ਰਮੋਟ ਕਰ ਰਹੇ ਨੇ ਅਤੇ ਜਿਵੇਂ ਕਿ ਪੰਜਾਬ ਦਾ ਕੋਈ ਵੀ ਮੁੱਦਾ ਗਾ ਕਿ ਕਿਆ ਉਸ ਦੇ ਉੱਪਰ ਕੋਈ ਪ੍ਰੋਬਲਮਸ ਨੇ ਉਹਦੇ ਉੱਪਰ ਹੀ ਜਿਵੇਂ ਉਹਨਾਂ ਨੇ ਕਿ ਗੀਤ ਵਗੈਰਾ ਜਾਂ ਰਿਐਲਿਟੀ ਮਤਲਬ ਹਰ ਇੱਕ ਤਾਂ ਵੈਸੇ ਗੀਤ ਹੁੰਦਾ ਇੱਕ ਆਪਣਾ ਪੱਖ ਆ ਜਿਹੜਾ ਉਹ ਸੱਚਾਈ ਨਾਲ ਪੇਸ਼ ਕਰਦੇ ਨੇ ਤਾਂ ਤੁਸੀਂ ਇਹਨਾਂ ਬਾਰੇ ਤਾਂ ਉਹਨਾਂ ਦੇ ਗਾਣੇ ਜਿਵੇਂ ਔਲਮੋਸਟ ਤਾਂ ਬਹੁਤ ਸਾਰੇ ਫੇਮਸ ਨੇਗੇ ਤਾਂ ਜਿਵੇਂ ਆਪਾਂ ਕਹਿ ਲਓ ਵੀ ਮੇਨ ਜਿਹੜਾ ਬਹੁਤ ਹੀ ਦਿਲ ਨੂੰ ਟੁੰਬਦਾ ਵੀ ਮਾਂ ਮੈਂ ਜਮਾਂ ਤੇਰੇ ਵਰਗਾ ਗਾ ਅਤੇ ਮੈਂ ਉਹ ਸੌਂਗ ਮੋਸਟਲੀ ਹਰ ਇੱਕ ਨੂੰ ਬਹੁਤ ਪਿਆਰਾ ਜਾਂ ਬਹੁਤ ਅੱਛਾ ਲੱਗਦਾ ਗਾ ਇਸ ਤਰ੍ਹਾਂ ਦੇ ਸੌਂਗ ਜਿਵੇਂ ਹੋ ਗਏ ਤਾਂ ਉਹ ਸਾਰੇ ਬਹੁਤ ਅੱਛੇ ਨੇ ਹਾਂ ਤੁਸੀਂ ਇਹਨਾਂ ਬਾਰੇ ਬਹੁਤ ਵਧੀਆ ਲਿਖ ਸਕਦੇ ਹੋ ਹਾਂਜੀ ਹਾਂਜੀ ਹਾਂਜੀ ਜਿਵੇਂ ਹਾਂ ਹਾਂ ਜਿਵੇਂ ਉਹਨਾਂ ਦੀ ਸਕੂਲਿੰਗ ਹੈ ਜਿਹੜੀ ਉਹ ਮਾਨਸਾ ਦੇ ਵਿੱਚ ਹੀ ਵਿੱਦਿਆ ਭਾਰਤੀ ਸਕੂਲ ਹੈ ਚੇਤਨ ਸਿੰਘ ਤਾਂ ਸਰਵ ਹਿਤਕਾਰੀ ਸਕੂਲ ਹੀ ਹੈਗਾ ਤਾਂ ਉਹਦੇ ਵਿੱਚ ਹੀ ਉਹਨਾਂ ਨੇ ਆਪਣੀ ਜਿਹੜੀ ਹੈਗੀ ਸਕੂਲਿੰਗ ਪੂਰੀ ਕੀਤੀ ਆ ਉਸ ਤੋਂ ਬਾਅਦ ਫਿਰ ਬਾਕੀ ਸਟੱਡੀ ਉਹਨਾਂ ਨੇ ਲੁਧਿਆਣਾ ਤੋਂ ਯੂਨੀਵਰਸਿਟੀ ਤੋਂ ਫਿਰ ਉਹਨਾਂ ਨੇ ਆਇਲਸ ਕਰਕੇ ਕੈਨੇਡਾ ਤੋਂ ਵੀ ਮਤਲਬ ਸਟੱਡੀ ਕੀਤੀ ਹੈ ਲੇਕਿਨ ਉਹਨਾਂ ਦੀ ਮੇਨ ਓਕੇ ਜੀ ਹਾਂਜੀ ਠੀਕ ਹੈ ਜੀ ਓਕੇ ਜੀ ਓਕੇ